ਪੇਂਡੂ ਉਦਮੀਆਂ ਨੂੰ ਦਰਪੇਸ਼ ਚੁਣੌਤੀਆਂ ਉਮੀਦ ਭਰੀਆਂ ਸੰਭਾਵਨਾਵਾਂ ਦੇ ਬਾਵਜੂਦ ਪੇਂਡੂ ਉਦਮੀਆਂ ਨੂੰ ਆਪਣੇ ਵਾਤਾਵਰਨ ਲਈ ਵਿਲੱਖਣ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪੂੰਜੀ ਤੱਕ ਸੀਮਤ ਪਹੁੰਚ ਨਾ ਕਾਫੀ ਬੁਨਿਆਦੀ ਢਾਂਚਾ ਅਤੇ ਬਜ਼ਾਰ ਦੀ ਜਾਣਕਾਰੀ ਦੀ ਘਾਟ ਮਹੱਤਵਪੂਰਨ ਰੁਕਾਵਟ ਪੈਦਾ ਕਰਦੀ ਹੈ ਇਸ ਤੋਂ ਇਲਾਵਾ ਨੁਜਸਟਿਕ ਚੁਣੌਤੀਆਂ ਜਿਵੇਂ ਕਿ ਆਵਾਜਾਈ ਅਤੇ ਸਪਲਾਈ ਚੇਨ ਦੇ ਮੁੱਦੇ ਕਾਰੋਬਾਰੀ ਕਾਰਜਾਂ ਵਿੱਚ ਰੁਕਾਵਟ ਪਾ ਸਕਦੇ ਹਨ ਇਸ ਤੋਂ ਇਲਾਵਾ ਸੱਭਿਆਚਾਰਕ ਅਤੇ ਸਮਾਜਿਕ ਰੁਕਾਵਟਾਂ ਕੁਝ ਭਾਈਚਾਰਿਆਂ ਵਿੱਚ ਇਹ ਉਦਮੀ ਪਹਿਲ ਕਦਮੀਆਂ ਨੂੰ ਰੋਕ ਸਕਦੇ ਹਨ ਇਸ ਤੋਂ ਇਲਾਵਾ ਪੈਸੇ ਦੀ ਕਮੀ ਵਿੱਤ ਤੱਕ ਪਹੁੰਚ ਪੇਂਡੂ ਉਦਮੀਆਂ ਲਈ ਇੱਕ ਮਹੱਤਵਪੂਰਨ ਰੁਕਾਵਟ ਬਣੀ ਹੋਈ ਹੈ ਰਪੈ ਰਵਾਇਤੀ ਵਿੱਤੀ ਸੰਸਥਾਵਾਂ ਅਕਸਰ ਪੇਂਡੂ ਉਦਮੀ ਜੋ ਕੰਮ ਭਰਭੂਰ ਸਮਝਦੀਆਂ ਹਨ ਅਤੇ ਕਰਜ਼ਾ ਜਾਂ ਨਿਵੇਸ਼ ਪੂੰਜੀ ਪ੍ਰਦਾਨ ਪ੍ਰਦਾਨ ਕਰਨ ਤੋਂ ਝਿਜਕਦੀਆਂ ਹਨ ਨਤੀਜੇ ਵਜੋਂ ਉਦਮੀ ਆਪਣੇ ਕਾਰੋਬਾਰ ਨੂੰ ਸ਼ੁਰੂ ਕਰਨ ਜਾਂ ਵਧਾਉਣ ਲਈ ਲੋੜੀਂਦੇ ਫੰਡਾਂ ਨੂੰ ਸੁਰੱਖਿਅਤ ਕਰਨ ਲਈ ਸੰਘਰਸ਼ ਕਰਦੇ ਹਨ ਇਸ ਤੋਂ ਇਲਾਵਾ ਬੁਨਿਆਦੀ ਢਾਂਚੇ ਦੀਆਂ ਸਮੱਸ ਸੀਮਾਵਾਂ ਖਰਾਬ ਸੜਕ ਸੰਪਰਕ ਗੈਰ ਭਰੋਸੇਯੋਗ ਬਿਜਲੀ ਸਪਲਾਈ ਦੂਰ ਸੰਚਾਰ ਤੱਕ ਸੀਮਤ ਪਹੁੰਚ ਸਮੇਤ ਨਾ ਕਾਫੀ ਬੁਨਿਆਦੀ ਢਾਂਚਾ ਪੇਂਡੂ ਖੇਤਰਾਂ ਵਿੱਚੋਂ ਕਾਰੋਬਾਰ ਦੇ ਵਿਕਾਸ ਵਿੱਚ ਰੁਕਾਵਟ ਪੈਦਾ ਕਰਦਾ ਹੈ ਉੱਚਿਤ ਬੁਨਿਆਦੀ ਢਾਚੇ ਤੋਂ ਬਿਨਾਂ ਉਦਮੀਆਂ ਨੂੰ ਕੱਚੇ ਮਾਲ ਦੀ ਖੀਰ ਬਜ਼ਾਰਾਂ ਤੱਕ ਪਹੁੰਚਣ ਅਤੇ ਗ੍ਰਾਹਕਾਂ ਨੂੰ ਉਤਪਾਦਾਂ ਜਾਂ ਸੇਵਾਵਾਂ ਪ੍ਰਦਾਨ ਕਰਨ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤੋਂ ਇਲਾਵਾ ਮਾਰਕੀਟ ਜਾਗਰੂਕਤਾ ਬਾਜ਼ਾਰ ਦੀ ਜਾਣਕਾਰੀ ਅਤੇ ਖਪਤਕਾਰਾਂ ਦੀ ਸੂਝ ਤੱਕ ਸੀਮਤ ਪਹੁੰਚ ਪੇਂਡੂ ਉਦਮੀਆ ਲਈ ਵਿਵਹਾਰਕ ਕਾਰੋਬਾਰੀ ਮੌਕਿਆਂ ਦੀ ਪਛਾਣ ਅਤੇ ਕਾਰਨ ਬਜ਼ਾਰ ਦੇ ਬਦਲਦੇ ਰੁਝਾਨਾਂ ਨੂੰ ਅਨੁਕੂਲ ਬਣਾਉਣਾ ਚੁਣੌਤੀਪੂਰਨ ਬਣਾਉਂਦੀ ਹੈ ਮਾਰਕੀਟ ਦੇ ਵਿਚ ਜਾਗਰੂਕਤਾ ਦੀ ਘਾਟ ਅਕਸਰ ਉਤਪਾਦ ਸੀਮਾਵਾਂ ਬੇਮੋਲੀਆਂ ਕੀਮਤਾਂ ਦੀ ਸਮਰਥਾ ਅਤੇ ਮਾਰਕੀਟਿੰਗ ਅਸਮਰਥਾ ਕਾਰਨ ਬਣਦੀ ਹੈ ਚੁਣੌਤੀਆਂ ਦੇ ਬਾਵਜੂਦ ਪੇਂਡੂ ਉਦਮਤਾ ਦੇ ਕਈ ਫਾਇਦੇ ਪ੍ਰਦਾਨ ਕਰਦੇ ਹੈ ਜਿਸ ਵਿੱਚ ਚਾਹਵਾਨ ਕਾਰੋਬਾਰੀ ਮਾਲਕਾਂ ਲਈ ਇੱਕ ਅਕਰਸ਼ਕ ਸਭਾਵਨਾ ਬਣਾਉਂਦੀ ਹੈ ਇਹਨਾਂ ਫਾਇਦਿਆਂ ਨੂੰ ਸਮਝਣਾ ਉਦਮੀਆਂ ਨੂੰ ਪੇਂਡੂ ਬਜ਼ਾਰਾਂ ਦੁਆਰਾ ਪੇਸ਼ ਕੀਤੇ ਵਿਲੱਖਣ ਮੌਕਿਆਂ ਦਾ ਲਾਭ ਉਠਾਉਣ ਵਿੱਚ ਮਦਦ ਪ੍ਰਦਾਨ ਕਰਦਾ ਹੈ ਸ਼ਹਿਰੀ ਖੇਤਰਾਂ ਦੀ ਤੁਲਨਾ ਵਿੱਚ ਪੇਂਡੂ ਬਜ਼ਾਰਾਂ ਵਿੱਚ ਆਮ ਤੌਰ 'ਤੇ ਮੁਕਾਬਲੇ ਦਾ ਪੱਧਰ ਘੱਟ ਹੁੰਦਾ ਹੈ ਜਿਸ ਨਾਲ ਉਦਮੀਆਂ ਨੂੰ ਵਿਸ਼ੇਸ਼ ਬਜ਼ਾਰ ਬਣਾਉਣ ਅਤੇ ਆਪਣੇ ਸੰਬੰਧਿਤ ਉਦਯੋਗਾਂ ਵਿੱਚ ਸਥਾਨ ਨੇਤਾ ਵਜੋਂ ਵਜੋਂ ਸਥਾਪਿਤ ਕਰਨ ਦੀ ਆਗਿਆ ਮਿਲਦੀ ਹੈ ਬਜ਼ਾਰ ਦੇ ਹਿੱਸੇਦਾਰੀ ਲਈ ਘੱਟ ਮੁਕਾਬਲੇ ਵਾਜਾ ਦੇ ਨਾਲ ਪੇਂਡੂ ਕਾਰੋਬਾਰਾਂ

ਸਥਾਨਕ ਭਾਈਚਾਰੇ ਨਾਲ ਸਰਗਰਮੀ ਨਾਲ ਜੁੜ ਕੇ ਕਾਰੋਬਾਰ ਆਪਣੇ ਬਣੇ ਅਤੇ ਇਕਜੁਟਤਾ ਦੀ ਭਾਵਨਾ ਪੈਦਾ ਕਰ ਸਕਦੇ ਹਨ ਜੋ ਉਹਨਾਂ ਨੂੰ ਸਫਲਤਾ ਵਿੱਚ ਮਹੱਤਵਪੂਰਨ ਹੋ ਸਕਦਾ ਹੈ ਪਿੰਡ ਅਤੇ ਪੇਂਡੂ ਖੇਤਰ ਵਿੱਚ ਅਕਸਰ ਕੁਦਰਤੀ ਸਰੋਤਾਂ ਨਾਲ ਭਰਪੂਰ ਹੁੰਦੇ ਹਨ ਜਿਹਨਾਂ ਵਿੱਚ ਉਪਜਾਊ ਜ਼ਮੀਨ ਜਲ ਸਰੋਤ ਜੈਵਿਕ ਵਿਭਿੰਨਤਾ ਸ਼ਾਮਿਲ ਹਨ ਉਦਮੀ ਇਹਨਾਂ ਸਰੋਤਾਂ ਨਾਲ ਲਾਭ ਮੁੱਲ ਜੋੜੇ ਉਤਪਾਦਾਂ ਜਿਵੇਂ ਕਿ ਜੈਵਿਕ ਭੋਜਨ ਜੜੀ ਬੂਟੀਆਂ ਦੀਆਂ ਦਵਾਈਆਂ ਅਤੇ ਵਾਤਾਵਰਨ ਅਨੁਕੂਲ ਸ਼ਿਲਪਕਾਰੀ ਬਣਾਉਣ ਲਈ ਕਰ ਸਕਦੇ ਹਨ ਕੁਦਰਤੀ ਸ਼ਕਤੀ ਦੀ ਵਰਤੋਂ ਕਰਕੇ ਪੇਂਡੂ ਕਾਰੋਬਾਰ ਬਜ਼ਾਰ ਵਿੱਚ ਆਪਣੇ ਆਪ ਨੂੰ ਇੱਕ ਵੱਖਰਾ ਕਰ ਸਕਦੇ ਹਨ ਅਤੇ ਵਾਤਾ ਪ੍ਰਤੀ ਵਾਤਾਵਰਨ ਪ੍ਰਤੀ ਸੁਚੇਤ ਖਪਤਕਾਰਾਂ ਨੂੰ ਅਪੀਲ ਕਰ ਸਕਦੇ ਹਨ ਹੁਣ ਆਓ ਭਾਰਤ ਦੇ ਪਿੰਡਾਂ ਅਤੇ ਪੇਂਡੂ ਖੇਤਰਾਂ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ ਕੁਝ ਉਮੀਦ ਭਰੇ ਕਾਰੋਬਾਰਾਂ ਦੀ ਵਿਚਾਰ ਕਰੀਏ ਜਿਵੇਂ ਕਿ ਖੇਤੀਬਾੜੀ ਅਤੇ ਖੇਤੀ ਦਸਤਕਾਰੀ ਅਤੇ ਕਾਰੀਗਰ ਉਤਪਾਦ ਖੇਤੀਬਾੜੀ ਅਧਾਰਤ ਉਦਯੋਗ ਪੇਂਡੂ ਸੈਰ ਸਪਾਟਾ ਪੇਂਡੂ ਹੈਲਥ ਸੇਵਾਵਾਂ ਨਵਿਆਉਣ ਊਰਜਾ ਹੱਲ ਸਿੱਖਿਆ ਅਤੇ ਹੁਨਰ ਵਿਕਾਸ ਪਹਿਲ ਕਦਮੀਆ ਈ ਕਮਰਸ ਅਤੇ ਆਨਲਾਈਨ ਮਾਰਕੀਟ ਪਲੇਸ ਰਹਿੰਦ ਖੂੰਹਦ ਪ੍ਰਬੰਧ ਹੱਲ ਜੈਵਿਕ ਖੇਤੀ ਉਦਮ ਇਹ ਸਾਰਾ ਕੁਛ ਕਰਨ ਦੇ ਨਾਲ ਅਸੀਂ ਸਾਡੇ ਪੇਂਡੂ ਬਿਜਨਸ ਨੂੰ ਉੱਚਾਈ ਵੱਲ ਲੈ ਕੇ ਜਾ ਸਕਦੇ ਹਾਂ